ਸਤਿ ਸ਼੍ਰੀ ਅਕਾਲ ਮੇਰਾ ਨਾਮ ਵਾਸੁਦਾ ਹੈ ਅਤੇ ਮੈਂ ਜ਼ਿਲ੍ਹਾ ਨਿਵਾਸੀ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਮੈਂ ਅੱਜ ਔਰਡਰ ਕੀਤਾ ਸੀ ਅਤੇ ਉਸ ਔਰਡਰ ਨੂੰ ਮੈਂ ਕੈਂਸਲ ਕਰ ਦਿੱਤਾ ਹੈ ਕਿਉਂਕਿ ਮੈਂ ਪੀਜ਼ਾ ਔਰਡਰ ਕੀਤਾ ਸੀ ਅਤੇ ਮੈਨੂੰ ਯਾਦ ਆਇਆ ਕਿ ਅੱਜ ਹੰਗਰੀ ਪੁਆਇੰਟ 'ਤੇ ਔਫਰ ਹੁੰਦਾ ਹੈ ਜਿਸ ਨਾਲ ਇੱਕ ਪੀਜ਼ਾ ਤਾਂ ਤੁਹਾਨੂੰ ਫ੍ਰੀ ਮਿਲਦਾ ਹੈ ਜੋ ਕਿ ਮੈਂ ਇਸ ਔਰਡਰ ਨੂੰ ਕੈਂਸਲ ਕਰ ਦਿੱਤਾ ਹੈ ਅਤੇ ਮੈਂ ਆਪਣਾ ਅਗਲਾ ਔਰਡਰ ਪੀਜ਼ਾ ਮੰਗਵਾਉਣਾ ਚਾਹੁੰਦੀ ਹਾਂ ਜੋ ਕਿ ਮੈਂ ਅਗਲਾ ਮੇਰੇ ਮੇਰੇ ਕੋਲ ਤੀਹ ਪ੍ਰਸੈਂਟ ਕੂਪਨ ਵਾਲਾ ਵੀ ਪਏ ਦਾ ਸੀ ਅਤੇ ਮੈਂ ਉਸਨੂੰ ਯੂਜ ਕਰਕੇ ਇਹ ਔਰਡਰ ਕੀਤਾ ਹੈ ਅਤੇ ਮੈਂ ਅੱਜ ਓਨੀਅਨ ਵਾਲਾ ਪੀਜ਼ਾ ਖਾਧਾ ਹੈ ਅਤੇ ਉਹ ਬਹੁਤ ਹੀ ਜ਼ਿਆਦਾ ਟੇਸਟੀ ਸੀ ਅਤੇ ਮੈਂ ਉਹਨਾਂ ਨੂੰ ਰੀਵਿਊ ਵਿੱਚ ਬਹੁਤ ਹੀ ਚੰਗੀ ਗੱਲਾਂ ਲਿਖ ਦਿੱਤੀਆਂ ਹਨ ਕਿ ਜੋ ਕਿ ਲੋਕਾਂ ਨੂੰ ਵੀ ਪਤਾ ਲੱਗੇ ਕਿ ਹੰਗਰੀ ਪੁਆਇੰਟ ਦਾ ਪੀਜ਼ਾ ਬਹੁਤ ਵਧੀਆ ਹੁੰਦਾ ਹੈ ਇਸ ਕਰਕੇ ਮੈਂ ਵੀ ਤੁਹਾਨੂੰ ਦੱਸਣ ਲੱਗੀ ਹਾਂ